ਹੈਲੋ ਹ ਡਰੈਵਰ ਹਰਦੀਪ ਸਿੰਘ ਜੀ ਬੋਲ ਰਹੇ ਹੈ ਜੀ ਮੈਂ ਮਾਨਾ ਵਾਲਾ ਤੋਂ ਹੀਰਾ ਸਿੰਘ ਬੋਲ ਰਿਹਾ ਹੂੰ ਜੀ ਕੁਛ ਦਿਨ ਪਹਿਲਾਂ ਤੁਹਾਡੇ ਕੋਂ ਗ ਅਸੀਂ ਗੱਡੀ ਬੁੱਕ ਕਰਵਾਈ ਸੀ ਦੋ ਹਜ਼ਾਰ ਰੁਪਏ ਵਿੱਚ ਅਸੀਂ ਸਾਰੀ ਫੈਮਲੀ ਮਾਨਾ ਵਾਲਾ ਤੋਂ ਜਲੰਧਰ ਜਾਣਾ ਸੀ ਭਾਅ ਜੀ ਮੈਂ ਪੈਸੇ ਉਸੇ ਦਿਨ ਦੇ ਗਿਆ ਸੀ ਜਿਸ ਦਿਨ ਬੁੱਕ ਕਰਵਾਈ ਸੀ ਪਰ ਹੁਣ ਬੁਕ ਕੈਂ ਬੁਕਿੰਗ ਕੈਂਸਲ ਕਰਵਾਉਣੀ ਹੈ ਕਿਉਂਕਿ ਸਾਡੇ ਘਰ ਕੋਈ ਮੁਸ਼ਕਿਲ ਹੋ ਗਈ ਹੈ ਕਿਰਪਾ ਕਰਕੇ ਅਸੀਂ ਨਹੀਂ ਜਾ ਸਕਦੇ ਤੁਸੀਂ ਸਾਡੇ ਪੈਸੇ ਵਾਪਸ ਕਰ ਦਿਓ ਭਾਅ ਜੀ ਅਸੀਂ ਤੁਹਾਡੇ ਕੋਲੋਂ ਪੈਸੇ ਲੈਣ ਕਦੋਂ ਆਈਏ ਜੀ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵਾਂਗੇ ਬੜੀ ਮੇਹਰਬਾਨੀ ਹੋਊਗੀ ਤੁਸੀਂ ਸਾਨੂੰ ਕਿਰਪਾ ਕਰਕੇ ਦੱਸ ਦਿਓ ਕਿ ਤੁਹਾਡੇ ਕੋਲ ਪੇਸੈ ਕਿੱਦਣ ਲੈਣ ਆਈਏ